ਹੈਲੋ ਇਸਾਨ ਕੁਮਾਰ ਬੋਲਦੇ ਭਾਅ ਜੀ ਮੈਂ ਅਭਿਸ਼ੇਕ ਬੋਲਦਾ ਸੀਗਾ ਨੇ ਬੱਚੇ ਦੇ ਬਾਰੇ ਪੁੱਛਣਾ ਸੀ ਹੁਸ਼ਿਆਰਪੁਰ 'ਚ ਵਧੀਆ ਸਕੂਲ ਕਿਹੜੇ ਆ ਪਹਿਲਾ ਸਰਕਾਰੀ ਦੱਸ ਦੋ ਹਾਂਜੀ ਹੋ ਇਹਨਾਂ ਦੀ ਫੀਸ ਕੀ ਹੋ ਗਈ ਅੱਛਾ ਅੱਛਾ ਤੇ ਪੜ੍ਹਾਈ ਵਗੈਰਾ ਇਥੇ ਕਿਦਾਂ ਦੀ ਹੁੰਦੀ ਆ ਅੱਛਾ ਪ੍ਰਾਈਵੇਟ ਸਕੂਲ ਦਾ ਕਿਹੜੇ ਕਿਹੜੇ ਵਧੀਆ ਪੰਜਾਬ ਪਹਿਲਾਂ ਪੰਜਾਬ ਬੋਰਡ ਦੱਸ ਦੋ ਹਾਂਜੀ ਹੋਰ ਹਾਂਜੀ ਹੋਰ ਅੱਛਾ ਇਹਨਾਂ ਦੀ ਪੜਾਈ ਕਿੱਦਾਂ ਇਹਨਾਂ ਦੀ ਇਹਨਾਂ ਦੀ ਇਹਨਾਂ ਦਾ ਪੀ ਸਟਰਕਚਰ ਕੀ ਆ ਮਹੀਨੇ ਦੀ ਠੀਕ ਹੈ ਠੀਕ ਤੇ ਸੀ ਬੀ ਐਸ ਈ ਦਾ ਦੱਸ ਦੋ ਸੀ ਬੀ ਐਸ ਈ ਕਿਹੜੇ ਕਿਹੜੇ ਸਕੂਲ ਆ ਨਹੀਂ ਚਲੋ ਉਹ ਤਾਂ ਕੋਈ ਨੀ ਹਾਂਜੀ ਹਾਂਜੀ ਇਹ ਕਿੱਦਾਂ ਦੇ ਆ ਭਾਅ ਜੀ ਇਸ ਲਈ ਇਹ ਸੀ ਬੀ ਐਸ ਈ ਬਾਰੇ ਦੱਸਿਓ ਕਿੱਦਾਂ ਦੇ ਸਕੂਲ ਵਧੀਆ ਤੇ ਇਹਨਾਂ ਦੀ ਫੀਸ ਕਿੰਨੀ ਹੋਊਗੀ ਅੱਛਾ ਅੱਛਾ ਵੁਡਲੈਂਡ ਸਕੂਲ ਭਾਅ ਜੀ ਮੈਂ ਬਹੁਤ ਨਾਮ ਸੁਣਿਆ ਇਹ ਵਧੀਆ ਲੱਗਦਾ ਵਾ ਅੱਛਾ ਅੱਛਾ ਤੇ ਟਰਿਪਲੇ ਅੱਛਾ ਅੱਛਾ ਤੇ ਆਈ ਸੀ ਐਸ ਸੀ ਬਾਰੇ ਵੀ ਦੱਸ ਦੋ ਹਾਂਜੀ ਇਹ ਕਿੱਦਾਂ ਦੇ ਇਹਨਾਂ ਦੀ ਫੀਸ ਕਿੰਨੀ ਹੋਊਗੀ ਤੁਸੀਂ ਮਤਲਵ ਤੁਸੀਂ ਕਿਹੜਾ ਜਿਆਦਾ ਪ੍ਰੈਫਰ ਕਰਦੇ ਸੀ ਬੀ ਐਸ ਈ ਕੇ ਆਈ ਸੀ ਐਸ ਈ ਠੀਕ ਹੈ ਠੀਕ ਹੈ

ਠੀਕ ਹੈ ਠੀਕ ਹੈ ਓਕੇ ਭਾਅ ਜੀ ਥੈਂਕ ਯੂ ਥੈਂਕ ਯੂ